ਮੈਨੂੰ ਕੱਲ੍ਹ ਹੀ ਆਪਣੀ ਤਨਖਾਹ ਮਿਲੀ ਹੈ ਅਤੇ ਮੈਂ ਆਪਣਾ ਪੂਰੇ ਸਾਲ ਦਾ ਟੈਕਸ ਰਿਟਰਨ ਭਰਨਾ ਚਾਹੁੰਦੀ ਹਾਂ ਅਤੇ ਮੈਂ ਚਾਹੁੰਦੀ ਹਾਂ ਕਿ ਮੈਨੂੰ ਵੱਧ ਤੋਂ ਵੱਧ ਕਟੌਤੀਆਂ ਅਤੇ ਛੂਟਾਂ ਦਾ ਲਾਭ ਮਿਲੇ ਕਿਉਂਕਿ ਮੈਂ ਇੱਕ ਮੱਧਮ ਵਰਗ ਨਾਲ ਸੰਬੰਧ ਰੱਖਦੀ ਹਾਂ ਅਤੇ ਮੇਰੀ ਤਨਖਾਹ ਵੀ ਉੰਨੀ ਜ਼ਿਆਦਾ ਨਹੀਂ ਇਸ ਲਈ ਮੈਂ ਚਾਹੁੰਦੀ ਹਾਂ ਕਿ ਮੈਨੂੰ ਇਹਨਾਂ ਚੀਜ਼ਾਂ ਦਾ ਲਾਭ ਮਿਲ ਸਕੇ ਅਤੇ ਮੈਂ ਇਹ ਟੈਕਸ ਆਨਲਾਈਨ ਹੀ ਭਰਾ ਭਰਾਂਗੀ ਕਿਉਂਕਿ ਮੈਂ ਮੇ ਕੋਲ ਇੰਨਾ ਸਮੇਂ ਨਹੀਂ ਹੈਗਾ ਕਿ ਮੈਂ ਕਿਸੇ ਸਾਈਬਰ ਕੈਫੇ 'ਤੇ ਜਾ ਕੇ ਟੈਕਸ ਭਰ ਸਕਾਂ ਧੰਨਵਾਦ